ਮੈਨੂੰ ਬ੍ਰਹਿਮੰਡ ਬਾਰੇ ਕੋਈ ਗਿਆਨ ਤਾਂ ਨਹੀਂ ਹੈ ਪਰ ਜਿਸ ਤਰ੍ਹਾਂ ਕਿ ਪਹਿਲਾਂ ਸਾਡੇ ਦਾਦੀ ਦੱਸਦੀ ਸੀ ਕਿ ਬ੍ਰਹਿਮੰਡ ਜਿਸ ਤਰ੍ਹਾਂ ਕਿ ਧਰਤੀ ਧਰਤੀ ਬਲਦੀ ਬਲਦ ਦੇ ਸਿੰਗ 'ਤੇ ਖੜ੍ਹੀ ਸਿੰਗ 'ਤੇ ਖੜ੍ਹੀ ਹੈ ਜਦ ਉਹ ਇੱਕ ਸਿੰਗ ਤੋਂ ਦੂਜੇ ਸਿੰਗ 'ਤੇ ਧਰਤੀ ਦਾ ਬੋਝ ਲੈਂਦਾ ਹੈ ਤਾਂ ਧ ਭੁਚਾਲ ਆਉਂਦੇ ਸਨ ਆਉਂਦੇ ਹਨ ਪਰ ਅੱਜ ਦੇ ਗਿਆਨ ਅਤੇ ਵਿਗਿਆਨ ਨੇ ਇਹ ਗੱਲ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਬ੍ਰਹਿਮੰਡ ਇਸ ਤਰ੍ਹਾਂ ਦਾ ਕੁਛ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਪੁਰਾਣੇ ਆਦਿ ਆਦਿ ਵਿਚਾਰ ਹਨ ਸਾਨੂੰ ਅੱਜ ਦੇ ਸਮੇਂ ਵਿੱਚ ਇਹ ਕਿਹਾ ਗਿਆ ਹੈ ਕਿ ਧਰਤੀ ਗੋਲ ਹੈ ਪਰ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਅੰਧ ਵਿਸ਼ਵਾਸ ਅੱਜ ਦੇ ਸਮੇਂ ਵਿੱਚ ਸਾਰੇ ਅੰਧ ਵਿਸ਼ਵਾਸ ਪਿੱਛੇ ਰਹਿ ਗਏ ਸਨ ਅਤੇ ਹੁਣ ਜਦ ਅਸੀਂ ਇਹ ਗੱਲਾਂ ਯਾਦ ਕਰਦੇ ਹਾਂ ਤਾਂ ਸਾਨੂੰ ਬਹੁਤ ਹਾਸਾ ਆਉਂਦਾ ਹੈ ਕਿ ਪਹਿਲਾਂ ਲੋਕ ਕਿਸ ਤਰ੍ਹਾਂ ਦਾ ਸੋਚਦੇ ਸਨ ਪਰ ਅੱਜ ਦੇ ਵਿਗਿਆਨਾਂ ਨੇ ਬਹੁਤ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ